ਹੈਲੋ ਹਾਂਜੀ ਹਾਂਜੀ ਹਾਂਜੀ ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦੀ ਹਾਂ

ਹਾਂਜੀ ਹਾਂਜੀ ਹਰ ਇੱਕ ਤਰ੍ਹਾਂ ਦਾ ਹੇਅਰ ਸਟਾਈਲ ਕਰ ਲੈਂਦੇ ਹਾਂ ਜਿਵੇਂ ਕਿ ਵਰੀਵ ਕਰਲ ਵੀ ਪਾ ਲੈਂਦੇ ਹਾਂ ਅਤੇ ਹੇਅਰ ਸਟੇਟ ਕਰ ਲੈਂਦੇ ਅਤੇ ਸਮੂਥਲਿੰਗ ਕਰ ਲੈਂਦੇ ਹਾਂ ਤੁਸੀਂ ਕਿਵੇਂ ਦਾ ਮਤਲਬ ਕਿ ਏਜ਼ ਦੇ ਅਕੋਡਿੰਗ ਤੁਸੀਂ ਕਿਵੇਂ ਦਾ ਪ੍ਰੈਫਰ ਕਰਦੇ ਹੋ ਠੀਕ ਹੈ ਹੋਰ ਮਤਲਬ ਤੁਸੀਂ ਪਰਾਂਦਾ ਵੀ ਲਗਾਉਣਾ ਚਾਹੁੰਦੇ ਹੋ ਜਾਂ ਐਵੇਂ ਹੀ ਗੁੱਤ ਕਰਨੀ ਹੈ ਤੁਸੀਂ ਠੀਕ ਹੈ ਹੋਰ ਅਤੇ ਫਿਰ ਮੈਰਿਜ਼ 'ਤੇ ਤੁਹਾਡੇ ਬਾ ਤੁਹਾਡੇ ਹੇਅਰ ਕਿਵੇਂ ਹੈ ਮਤਲਬ ਤੁਹਾਡੇ ਹੇਅਰ ਕਰਲੀ ਹੈ ਜਾਂ ਨੈਚੂਰਲ ਸਟੇਟ ਹੈ ਕਿਵੇਂ ਦੇ ਹੈ ਫਿਰ ਮੰਨੋ ਜੇ ਮੈਂ ਤੁਹਾਨੂੰ ਪ੍ਰੈਫਰ ਕਰਾਂ ਤਾਂ ਤੁਸੀਂ ਮੈਰਿਜ਼ 'ਤੇ ਹੇਅਰ ਨੂੰ ਕਰਲੀ ਕਰਵਾ ਲਓ ਬੰਨ ਦੀ ਜਗ੍ਹਾ 'ਤੇ ਹਾਂਜੀ ਹਾਂਜੀ ਤੁਸੀਂ ਜਦੋਂ ਵੀ ਕੋਲ ਕਰ ਲਿਓ ਤੁਸੀਂ ਮੈਨੂੰ ਹਾਂਜੀ ਮੋਸ ਮੋਸਟ ਵੈਲਕਮ